ਹੈਲੋ ਕੀ ਮੈਂ ਰਮੇਸ਼ ਨਾਲ ਗੱਲ ਕਰ ਰਿਹਾ ਜੀ ਮੈਂ ਇੱਕ ਓਲਾ ਬੁੱਕ ਕੀਤੀ ਸੀਗੀ ਜਿਸ ਵਿੱਚ ਤੁਸੀਂ ਮੇਰੇ ਡਰਾਈਵਰ ਨਿਯੁਕਤ ਹੋਏ ਹੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਰਾਮ ਨਗਰ ਤੋਂ ਚਾਂਦਨੀ ਚੌਂਕ ਜਾਣਾ ਹੈ ਇਸ ਵਾਸਤੇ ਮੈਨੂੰ ਤੁਹਾਡੀ ਟੈਕਸੀ ਦੀ ਲੋੜ ਹੈ ਮੇਰੇ ਨਾਲ ਇੱਕ ਬਜ਼ੁਰਗ ਔਰਤ ਹਨ ਅਤੇ ਉਹ ਇਨਾ ਜ਼ਿਆਦਾ ਚੱਲ ਫਿਰ ਨਹੀਂ ਸਕਦੇ ਇਸ ਕਰਕੇ ਮੈਂ ਚਾਹੁੰਦਾ ਕਿ ਤੋ ਤੁਸੀਂ ਸਾਨੂੰ ਘਰੋਂ ਹੀ ਚੁੱਕ ਲਉ ਸਾਡਾ ਘਰ ਰਾਮਨਗਰ ਵਿੱਚ ਦ ਗਲੀ ਨੰਬਰ ਦੋ ਮਕਾਨ ਨੰਬਰ ਪੰਦਰਾਂ ਹੈ ਮੈਂ ਤੁਹਾਡਾ ਉੱਥੇ ਇੰਤਜ਼ਾਰ ਕਰਾਂਗਾ ਸਾਨੂੰ ਚਾਂਦਨੀ ਚੌਂਕ ਵਿੱਚ ਇੱਕ ਪਾਰਟੀ ਵਿੱਚ ਜਾਣਾ ਹੈ ਸੋ ਮੈਂ ਚਾਹੁੰਦਾ ਕਿ ਤੁਸੀਂ ਥੋ ਥੋੜ੍ਹਾ ਜਲਦੀ ਆ ਸਕੋ ਤਾਂ ਬਹੁਤ ਚੰਗੀ ਗੱਲ ਹੈ ਤੁਹਾਡਾ ਧੰਨਵਾਦ ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ ਹਾਂ ਕਿਰਪਾ ਕਰਕੇ ਥੋੜ੍ਹਾ ਜਲਦੀ ਆਉਣ ਦੀ ਕੋਸ਼ਿਸ਼ ਕਰੋ